ਜੇਕਰ ਮੈਨੂੰ ਮੌਕਾ ਦਿੱਤਾ ਜਾਵੇ ਕਿ ਤੁਸੀਂ ਆਪਣੇ ਰਾਜ ਦੀਆਂ ਕਿਹੜੀਆਂ ਕਲਾ ਸ਼ੈਲੀਆਂ ਦੂਜੇ ਦੇਸ਼ਾਂ ਦੇਸ਼ਾਂ ਨੂੰ ਦਿਖਾਓਗੇ ਤਾਂ ਮੇਰੇ ਦੇ ਮੇਰੇ ਰਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਲਾਕ੍ਰਿਤੀਆਂ ਹਨ ਜਿਹੜੀਆਂ ਕਿ ਮੈਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਜ਼ਰੂਰ ਦਿਖਾਵਾਂਗਾ ਕਲਾਕ੍ਰਿਤੀਆਂ ਜਿਵੇਂ ਕਿ ਹੋ ਸਕਦੀਆਂ ਹਨ ਕਿ ਜਿਵੇਂ ਮੇਰੇ ਦੇਸ਼ ਦਾ ਕਬੱਡੀ ਜੋ ਹੈ ਮੇਰੇ ਰਾਜ ਦੀ ਕਬੱਡੀ ਹੈ ਬਹੁਤ ਫੇਮਸ ਹੈ ਜੋ ਕਬੱਡੀ ਹੈ ਮੈਂ ਉਹਨਾਂ ਲੋਕਾਂ ਨੂੰ ਕਬੱਡੀ ਦਾ ਟੂਰਨਾਮੈਂਟ ਕਰਵਾ ਕੇ ਦਿਖਾਵਾਂਗਾ ਉਹਨਾਂ ਨੂੰ ਦੱਸਾਂਗਾ ਕਬੱਡੀ ਵਿੱਚ ਕੀ ਹੁੰਦਾ ਹੈ ਕਿਵੇਂ ਜੋ ਖਿਡਾਰੀ ਹੁੰਦੇ ਹਨ ਇੱਕ ਦੂਜੇ ਨਾਲ ਮੇਲਜੋਲ ਨਾਲ ਕੰਮ ਕਰਦੇ ਹਨ ਮੇਲਜੋਲ ਨਾਲ ਖੇਡ ਖੇਡੀ ਜਾਂਦੀ ਹੈ ਅਤੇ ਉਹਨਾਂ ਵਿੱਚ ਏਕਤਾ ਦੀ ਭਾਵਨਾ ਭਰਦੀ ਹੈ ਅਤੇ ਉਹਨਾਂ ਨੂੰ ਨਾਲ ਹੀ ਨਾਲ ਮੈਂ ਆਪਣੇ ਰਾਜ ਦੀਆਂ ਭੰਗੜਾ ਅਤੇ ਗਿੱਧੇ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਦਿਖਾਵਾਂਗਾ ਮਤਲਬ ਰਾਜ ਦੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਨਾਚ ਵੀ ਦਿਖਾਵਾਂਗਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਮੇਰੇ ਜੋ ਰਾਜ ਦਾ ਭੰਗੜਾ ਹੈ ਉਹ ਕਿੰਨਾ ਫੇਮਸ ਹੈ ਅਤੇ ਲੋਕ ਕਿੰਨਾ ਉਸਨੂੰ ਉਤਸ਼ਾਹ ਨਾਲ ਦੇਖਦੇ ਹਨ ਅਤੇ ਇਸਦੇ ਨਾਲ ਨਾਲ ਉਹਨਾਂ ਨੂੰ ਪਤਾ ਲੱਗੇਗਾ ਕਿ ਭੰਗੜੇ ਵਿੱਚ ਕਿਸ ਤਰ੍ਹਾਂ ਦੇ ਜੋ ਸਟੈਪਸ ਕੀਤੇ ਜਾਂਦੇ ਆ ਕਬੱਡੀ ਦੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਉਹ ਸਿੱਖਣ ਨੂੰ ਮਿਲਣਗੀਆਂ ਕਿ ਕਿਵੇਂ ਦੋ ਖਿਡਾਰੀ ਇੱਕ ਦੂਜੇ ਨਾਲ ਮੇਲਜੋਲ ਨਾਲ ਕੰਮ ਕਰਦੇ ਹਨ